ਹੈਲੋ ਹਾਂ ਸਰ ਸੁਖਦੀਪ ਜੀ ਸੁਖਦੀਪ ਲੱਸੀ ਵਾਲੇ ਬੋਲ ਰਹੇ ਜੀ ਸੁੱਖੀ ਲੱਸੀ ਵਾਲੇ ਹਾਂਜੀ ਹਾਂਜੀ ਸਰ ਕੀ ਹਾਲ ਹੈ ਜੀ ਸਰ ਮੈਂ ਤੁਹਾਡਾ ਬੜਾ ਨਾਂ ਸੁਣਿਆ ਜੀ ਅਤੇ ਮੈਂ ਵਿਜਿਟ ਕਰਨਾ ਚਾਹੁੰਦਾ ਸੀ ਅਤੇ ਮੈਨੂੰ ਤੁਸੀਂ ਦੱਸ ਸਕਦੇ ਹੋ ਆਪਣੇ ਕੋਲ ਕਿਹੜੀ ਕਿਹੜੀ ਫਲੇਵਰ ਦੀ ਕਿਹੜੀ ਕਿਸ ਕਿਸ ਤਰ੍ਹਾਂ ਦੀ ਲੱਸੀ ਮਿਲ ਜਾਂਦੀ ਹੈ ਡੇਵੀਟ ਜਲੰਧਰ ਉਹ ਕਬੀਰ ਨਗਰ ਬਲਟਨ ਪਾਰਕ ਦੇ ਨੇੜੇ ਜਿਹੜਾ ਹੈਗਾ ਜੀ ਕਾਲਜ ਅੱਛਾ ਅੱਛਾ ਅੱਛਾ ਅੱਛਾ ਹਾਂਜੀ ਹਾਂਜੀ ਸਰ ਹਾਂਜੀ ਹਾਂਜੀ

ਹੁੰ ਹੁੰ ਹਾਂਜੀ ਹਾਂਜੀ ਅਤੇ ਉਹ ਇੱਕ ਸਰ ਇੱਕ ਮੇਰੇ ਫਰੈਂਡ ਆ ਉੱਥੇ ਰਹਿੰਦੇ ਨੇ ਤੁਹਾਡੇ ਨੇੜੇ ਉਹਨੇ ਹੀ ਮੈਨੂੰ ਦੱਸਿਆ ਸੀ ਕਿ ਜਿੱਦਾਂ ਇੱਕ ਕੋਈ ਤੁਹਾਡੇ ਸਟਰੋਬਰੀ ਫਲੇਵਰ ਦੀ ਲੱਸੀ ਵੀ ਹੈਗੀ ਹੈ ਸਰ ਬੜੀ ਫੇਮਸ ਹੈ ਉਹ ਜੀ ਮਿੱਠੀ ਲੱਸੀ ਹਾਂਜੀ ਹਾਂਜੀ ਸਰ ਮੈਂ ਐਕਚੁਲੀ ਮੈਂ ਥੋੜ੍ਹਾ ਜਲੰਧਰ ਦੇ ਬਾਹਰ ਰਹਿੰਦਾ ਅਤੇ ਮੈਨੂੰ ਉਹਨੇ ਬੜੀ ਤਾਰੀਫ ਕੀਤੀ ਅਤੇ ਮੈਂ ਕਿਹਾ ਮੈਂ ਵੀ ਪੁੱਛਾਂ ਵੀ ਕੀ ਖ਼ਾਸ ਹੈਗਾ ਉਹਦੇ ਵਿੱਚ ਅੱਛਾ ਅੱਛਾ

ਅਤੇ ਬਹੁਤ ਵਧੀਆ ਚੀਜ਼ ਹੈ ਸਰ ਕਿਉਂਕਿ ਇਸ ਕਰਕੇ ਹੀ ਮੈਂ ਫੋਨ ਕੀਤਾ ਕਿ ਮੈਂ ਉੱਥੇ ਜਾਵਾਂ ਅਤੇ ਉੱਥੇ ਜਾ ਕੇ ਤੁਸੀਂ ਫਲੇਵਰ ਪਾ ਦਿਓ ਤਾਂ ਉਹ ਮਜ਼ਾ ਉਹ ਤਾਂ ਇੱਥੇ ਵੀ ਮਿਲ ਜਾਣਾ ਸਰ ਫਲੇਵਰ ਕਿਸੇ ਵੀ ਤਰ੍ਹਾਂ ਦਾ ਮਿਲ ਜਾਂਦਾ ਜੀ ਅੱਜ ਕੱਲ੍ਹ ਤੁਹਾਨੂੰ ਪਤਾ ਹਰ ਚੀਜ਼ ਦਾ ਫਲੇਵਰ ਅਵੇਲੇਵਲ ਹੈਗਾ ਮੈਂ ਕਿਹਾ ਚਲੋ ਮੈਂ ਪਰਸਨਲੀ ਭਾਈ ਨੂੰ ਪੁੱਛ ਲਵਾਂ ਹੁੰ ਹੁੰ ਅੱਛਾ ਅੱਛਾ ਓਕੇ ਹੁੰ ਹੁੰ ਅਤੇ ਉਹ ਵੀ ਸਰ ਤੁਸੀਂ ਮਤਲਬ ਓ ਉਹ ਵੀ ਨੈਚੁਰਲ ਹੀ ਵਾਲੇ ਅੱਛਾ ਅੱਛਾ ਅਤੇ ਉਹ ਕੱਚੇ ਅੰਬ ਵਾਲਾ ਅਤੇ ਫਿਰ ਸਰ ਉਹ ਗਰਮੀਆਂ 'ਚ ਹੀ ਮਿਲੇਗਾ ਨਾ ਅੰਮਚੂਰ ਅੱਛਾ ਜੀ ਅੱਛਾ ਅੱਛਾ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਤੇ ਸਰ ਆਪਣੇ ਆਉਣਾ ਕਿੱਥੇ ਪਵੇਗਾ ਜੀ ਹਾਂਜੀ ਹਾਂਜੀ ਹਾਂਜੀ ਬਲਟਨ ਪਾਰਕ ਆਉਣਾ ਠੀਕ ਹੈ ਓਕੇ ਓਕੇ ਅਤੇ ਸਰ ਡਿਲੀਵਰੀ ਵੀ ਕਰ ਦਿੰਦੇ ਹੋ ਜਾਂ ਨਹੀਂ ਫਿਰ ਓ ਫਿਰ ਸਰ ਅਤੇ ਸਰ ਫਲੇ ਮਤਲਬ ਸਵਾਦ ਦਾ ਫ਼ਰਕ ਨਹੀਂ ਪੈ ਜਾਵੇਗਾ ਉ ਉੰਨੀ ਦੇਰ ਪੈਕ ਰਹੇਗੀ ਠੀਕ ਹੈ ਸਰ ਠੀਕ ਹੈ ਜੀ ਅਤੇ ਚਲੋ ਠੀਕ ਹੈ ਸਰ ਮੈਂ ਵਿਜਿਟ ਹੀ ਕਰਾਂਗਾ ਪਹਿਲਾਂ ਤਾਂ ਜੀ ਅਤੇ ਥੈਂਕ ਯੂ ਸਰ ਥੈਂਕ ਯੂ ਸੋ ਮੱਚ